ਸਾਡੇ ਆਲੇ ਦੁਆਲੇ ਦੇ ਏ ਟੀ ਅਮਸ ਜਿਹੜੇ ਨੇ ਉਹ ਵੈਸੇ ਤਾਂ ਵਧੀਆ ਨੇ ਅਤੇ ਪਰ ਇੱਥੇ ਕਈ ਵਾਰ ਨਗਦੀ ਦੀ ਕਮੀ ਆ ਜਾਂਦੀ ਆ ਵੈਸੇ ਤਾਂ ਇੱਥੇ ਹਮੇਸ਼ਾ ਨਗਦੀ ਹੁੰਦੀ ਹੁੰਦੀ ਏ ਟੀ ਐੱਮ 'ਚ ਪਰ ਉਦੋਂ ਕਮੀ ਆਉਂਦੀ ਜਦੋਂ ਛੁੱਟੀਆਂ ਹੋ ਜਾਣ ਤਾਂ ਉਸ ਸਮੇਂ ਸਾਨੂੰ ਬੜੀ ਮੁਸ਼ਕਲ ਆ ਜਾਂਦੀ ਕਈ ਵਾਰ ਜਦੋਂ ਬਹੁਤ ਲੋੜ ਹੋਵੇ ਅਤੇ ਉੱਪਰੋਂ ਨਗਦੀ ਨਾ ਮਿਲੇ ਅਤੇ ਮੈਂ ਇਹ ਚਾਹੂੰਗੀ ਕਿ ਇੱਥੇ ਮਤਲਬ ਕਿ ਹਰ ਟੈਮ ਇੱਦਾਂ ਹੀ ਰਹੇ ਸਾਫ ਸਫਾਈ ਵੀ ਹੁੰਦੀ ਆ ਅਤੇ ਇੱਥੇ ਸਾਡੇ ਲਾਗੇ ਐੱਚ ਡੀ ਐੱਫ ਸੀ ਅਤੇ ਐੱਸ ਬੀ ਆਈ ਦਾ ਏ ਟੀ ਐੱਮ ਆ ਅਤੇ ਇਹ ਜਿਹੜਾ ਵਾ ਵੈਸੇ ਤਾਂ ਬਹੁਤ ਵਧੀਆ ਜਿਹੜਾ ਸਰਕਾਰੀ ਸੈਕਟਰ ਆ ਉੱਥੇ ਕਈ ਕਈ ਵਾਰ ਜਿਹੜਾ ਵਾ ਉਹ ਸਮਾਂ ਬਹੁਤ ਲੱਗ ਜਾਂਦਾ ਜਿਵੇਂ ਲੰਮੀਆਂ ਲਾਈਨਾਂ ਹੋਣ ਕਾਰਨ ਪਰ ਪ੍ਰਾਈਵੇਟ ਸੈਕਟਰ ਇੱਥੇ ਬਹੁਤ ਵਧੀਆ ਵਾ ਉੱਥੇ ਨਾ ਤਾਂ ਲੰਮੀਆਂ ਲਾਈਨਾਂ ਹੁੰਦੀਆਂ ਵਾ ਅਤੇ ਨਾ ਹੀ ਕੋਈ ਨਗਦੀ ਦੀ ਕਮੀ ਆਉਂਦੀ ਆ ਪਰ ਸਰਕਾਰੀ ਵਾਲੇ ਲਾਈਨਾਂ ਵੈਸੇ ਤਾਂ ਲੰਮੀਆਂ ਹੁੰਦੀਆਂ ਇੱਥੇ ਅਤੇ ਪਰ ਇਹ ਆ ਕਿ ਇਹ ਵੀ ਬਹੁਤ ਵਧੀਆ ਨੇ ਇਸ ਕਰਕੇ ਮੈਂ ਇਹ ਕਹੂੰਗੀ ਕਿ ਪ੍ਰਾਈਵੇਟ ਅਤੇ ਸਰਕਾਰੀ ਦੋਵੇਂ ਸੈਕਟਰ ਬਹੁਤ ਵਧੀਆ ਨੇ